ਮੇਰੇ ਪਿੰਡ ਵਿੱਚ ਸਥਾਨਕ ਖੇਤੀਬਾੜੀ ਉਦਯੋਗ ਨੂੰ ਸਮਰਥਨ ਦੇ ਲਈ ਇੱਕ ਪਸ਼ੂਤਨ ਸਪਲਾਈ ਸਟੋਰ ਹੈ ਜਿੱਥੇ ਕਿ ਕੋਈ ਵੀ ਕਿਸਾਨ ਆਪਣੇ ਪਸ਼ੂ ਲਈ ਕਿਸੇ ਵੀ ਤਰ੍ਹਾਂ ਦਾ ਚਾਰਾ ਦਾਣਾ ਜਾਂ ਫੀਡ ਪ੍ਰਾਪਤ ਕਰ ਸਕਦਾ ਹੈ ਇਸ ਦੇ ਨਾਲ ਹੀ ਉੱਥੇ ਹਰ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਖਾਸ ਪ੍ਰਬੰਧ ਹੈ ਅਤੇ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਦਵਾਈ ਖਰੀਦ ਸਕਦਾ ਹੈ ਇਸ ਤੋਂ ਇਲਾਵਾ ਮੇਰੇ ਪਿੰਡ ਵਿੱਚ ਸਾਲਾਨਾ ਤੌਰ 'ਤੇ ਇੱਕ ਕਿਸਾਨ ਬਜ਼ਾਰ ਲੱਗਦਾ ਹੈ ਜਿਸ ਵਿੱਚ ਅਲੱਗ ਅਲੱਗ ਪ੍ਰਕਾਰ ਦੇ ਬੀਜ ਅਤੇ ਸਬਜ਼ੀਆਂ ਵੇਚੀਆਂ ਜਾਂਦੀਆਂ ਹਨ ਅਤੇ ਨਾਲ ਹੀ ਨਾਲ ਅਲੱਗ ਅਲੱਗ ਤਰ੍ਹਾਂ ਦੇ ਉਜਾਰ ਜੋ ਕਿ ਖੇਤੀਬਾੜੀ ਵਿੱਚ ਵਰਤੇ ਜਾਂਦੇ ਹਨ ਉਹ ਵੀ ਵੇਚੇ ਜਾਂਦੇ ਹਨ ਇਸ ਕਿਸਾਨ ਬਜ਼ਾਰ ਵਿੱਚ ਬਹੁਤ ਜ਼ਿਆਦਾ ਕਿਸਾਨ ਪਹੁੰਚਦੇ ਹਨ